ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂ ਤੁਹਾਡਾ ਸ਼ੁੱਭ ਨਾਮ ਠੀਕ ਹੈ ਜੀ ਹਾਂਜੀ ਉਹਨਾਂ ਦਾ ਨਾਮ ਠੀਕ ਆ ਠੀਕ ਹੈ ਜੀ ਕਿ ਨਹੀਂ ਕੋਈ ਗੱਲ ਨਹੀਂ ਅਸੀਂ ਹਾਂਜੀ ਹਾਂਜੀ ਨਹੀਂ ਤੁਹਾਡੀ ਪ੍ਰੋਬਲਮ ਨੂੰ ਜ਼ਰੂਰ ਰਿਜੋਲਵ ਕੀਤਾ ਜਾਊਗਾ ਕੋਈ ਗੱਲ ਨਹੀਂ ਤੁਸੀਂ ਆਪਣਾ ਨਾ ਸਾਰੀ ਡਿਟੇਲ ਮੈਨੂੰ ਭੇਜ ਦਿਓ ਵਟਸਐਪ ਕਰ ਦਿਓ ਇਸ ਨੰਬਰ 'ਤੇ ਠੀਕ ਹੈ ਹਾਂਜੀ ਹਾਂਜੀ ਹਾਂ ਉਹ ਤਾਂ ਠੀਕ ਹੈ ਕੋਈ ਇਸ਼ੂ ਸੀਗਾ ਤਾਂ ਤੁਸੀਂ ਤਾਂ ਹੀ ਆਪਣੀ ਲੈ ਕਿ ਆਏ ਪ੍ਰੋਬਲਮ ਉੱਥੇ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡੀ ਇਹ ਕੰਪਲੇਂਟ 'ਤੇ ਜ਼ਰੂਰ ਗੌਰ ਕੀਤਾ ਜਾਊਗਾ ਨਹੀਂ ਨਹੀਂ ਨਹੀਂ ਨਹੀਂ ਤੁਸੀਂ ਅਕਾਊਂਟ ਰਿਮੂਵ ਨਾ ਕਰਵਾਓ ਨਹੀਂ ਅਸੀਂ ਉਹਦੇ ਨਾਲ ਗੱਲ ਕਰਾਂਗੇ ਤਾਂ ਤੁਹਾਡੀ ਪ੍ਰੋਬਲਮ ਜ਼ਰੂਰ ਰਿਜੋਲਵ ਕੀਤੀ ਜਾਊਗੀ ਓਕੇ ਜੀ ਥੈਂਕ ਯੂ